ਪੰਜਾਬ ਦੇ ਵਿੱਚ ਬਹੁਤ ਸਾਰੇ ਸੱਭਿਆਚਾਰਕ ਪ੍ਰੰਪਰਾਵਾਂ ਨੇ ਸਭ ਤੋਂ ਪਹਿਲਾਂ ਤਾਂ ਬੱਚੇ ਦੇ ਜਨਮ ਦੇ ਵਿੱਚ ਜਿਹੜੀ ਗੁੜਤੀ ਦਿੱਤੀ ਜਾਂਦੀ ਹੈ ਉਸ ਗੁੜਤੀ ਦਾ ਮੰਨਿਆ ਜਾਂਦਾ ਹੈ ਕਿ ਜਿਹੜਾ ਪਰਸਨ ਉਸ ਬੱਚੇ ਨੂੰ ਗੁੜਤੀ ਦੇ ਰਿਹਾ ਏ ਕਿ ਉਹਦੇ 'ਚ ਚੰਗੇ ਗੁਣ ਨੇ ਉਸ ਬੱਚੇ ਦੇ ਥਰੂ ਅੰਦਰ ਮਤਲਬ ਦਿੱਤੇ ਜਿਹੜਾ ਬੰਦਾ ਦਿੰਦਾ ਗੁੜਤੀ ਉਹਦੇ ਅੰਦਰ ਆਉਂਦੇ ਹੈ ਉਸ ਤੋਂ ਬਾਅਦ ਸੱਭ ਤੋਂ ਵੱਡੀ ਜਿਹੜੀ ਉਸ ਤੋਂ ਨੈਕਸਟ ਜਿਹੜੀ ਪ੍ਰੰਪਰਾ ਮੰਨੀ ਜਾਂਦੀ ਹੈ ਜਾਂ ਰਸਮ ਮੰਨੀ ਜਾਂਦੀ ਹੈ ਉਹਦੇ ਵਿੱਚ ਪੱਗ ਦੀ ਰਸਮ ਵੱਡੀ ਮੰਨੀ ਜਾਂਦੀ ਹੈ ਪੱਗ ਦੇਣ ਦਾ ਮਤਲਬ ਹੁੰਦਾ ਹੈ ਪੰਜਾਬੀਆਂ ਦੇ ਵਿੱਚ ਕਿ ਇਹ ਬੱਚਾ ਗਾਂਹ ਸਿਆਣਾ ਹੋ ਗਿਆ ਆ ਅਤੇ ਇਹ ਘਰ ਦਾ ਮੁੱਖੀ ਆ ਅਤੇ ਇਹਨੂੰ ਹੀ ਅੱਗੇ ਜਾ ਕੇ ਆਪਣੇ ਘਰ ਦੇ ਜਾਂ ਘਰ ਦੇ ਰਿਸਪੋਂਸੀਬਿਲਟੀ ਸਾਰੀ ਸਾਂਭਣੀਆਂ ਹੈ ਅਤੇ ਇਸ ਕਰਕੇ ਉਹਨੂੰ ਪੱਗ ਦੀ ਰਸਮ ਨਾਲ ਨਿਵਾਜਿਆ ਜਾਂਦਾ ਆ ਉਸ ਤੋਂ ਬਾਅਦ ਗਾਂਹ ਜਦ ਬੱਚਾ ਜਵਾਨ ਹੁੰਦਾ ਆ ਤਾਂ ਉਸ ਤੋਂ ਬਾਦ ਵਿਆਹ ਦਾ ਜਿਹੜਾ ਆ ਜਾਂਦਾ ਹੈ ਪੰਜਾਬੀਆਂ ਦੇ ਵਿੱਚ ਮੋਸਟਲੀ ਲਾਵਾਂ ਦਾ ਹੈਗਾ ਏ ਆ ਜਿਹਦੇ ਵਿੱਚ ਗੁਰੂ ਘਰ ਜਾ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਲਾਵਾਂ ਲਈਆਂ ਜਾਂਦੀਆਂ ਨੇ ਅਤੇ ਲਾਵਾਂ ਚਾਰ ਹੁੰਦੀਆਂ ਨੇ ਅਤੇ ਉਹਦੇ ਵਿੱਚ ਗੁਰੂ ਦੇ ਸਾਰੇ ਪਾਠ ਕੀਰਤਨ ਸਾਰਾ ਕੁਛ ਸ਼ਾਮਿਲ ਹੁੰਦਾ ਆ ਅਤੇ ਉਹਦੇ ਵਿੱਚ ਲਾਵਾਂ ਤੋਂ ਬਾਅਦ ਬੱਚਾ ਆਪਣਾ ਵਿਵਾਹਿਕ ਜੀਵਨ ਸ਼ੁਰੂ ਕਰਦਾ ਆ ਅਤੇ ਆਹ ਸਾਰੀਆਂ ਪੰਜਾਬ ਦੀਆਂ ਮੁੱਖ ਪ੍ਰੰਪਰਾਵਾਂ ਜਾਂ ਰਿਵਾਜ਼ ਜਾਂ ਫਿਰ ਸੱਭਿਆਚਾਰਿਕ ਪ੍ਰੰਪਰਾ ਜੋ ਜਿਵੇਂ ਜਿੱਦਾਂ ਲੱਗਦਾ ਓ ਕਹਿ ਸਕਦਾ ਹੈ ਅਤੇ ਆਹ ਮੁੱਖ ਨੇ ਅਤੇ ਪੰਜਾਬ ਦੇ ਵਿੱਚ ਹਰ ਚੀਜ਼ ਬੜੀ ਸਿਸਟੇਮੈਟਿਕਲੀ ਤਰੀਕੇ ਨਾਲ ਕੀਤੀ ਜਾਂਦੀ ਆ ਅਤੇ ਬਾਕੀ